ਅੱਠ ਨਵੰਬਰ ਉੱਨੀ ਸੌ ਛਿਆਸੀ ਸਤਾਰਾਂ ਨਵੰਬਰ ਉੱਨੀ ਸੌ ਨੱਬੇ ਇੱਕ ਐਪ੍ਰੈਲ ਦੋ ਹਜ਼ਾਰ ਪੰਦਰਾਂ ਮਈ ਦੋ ਹਜ਼ਾਰ ਚਾਰ ਛੱਬੀ ਅਗਸਤ ਦੋ ਹਜ਼ਾਰ ਦਸ